ਹੈਲੋ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਮੈਡਮ ਜਤਿੰਦਰ ਬੋਲ ਰਹੀ ਹੋਰ ਬਸ ਬਸ ਠੀਕ ਹੈ ਤੁਸੀਂ ਸੁਣਾਓ ਬੱਚੇ ਠੀਕ ਹੈ ਮੈਡਮ ਛੋਟਾ ਬੇਟਾ ਨਾ ਸੈਕਿੰਡ ਕਲਾਸ 'ਚ ਹੈ ਅਤੇ ਮੈਂ ਤੁਹਾਡਾ ਵੀ ਬੇਟਾ ਸੈਕੰਡ 'ਚ ਹੈ ਨਾ ਉਹਦੇ ਨਾਲ ਹਾਂ ਹਾਣ ਸਵਾਣੀ ਨਾ ਸਾਡੇ ਛੋਟੇ ਬੱਚੇ ਅਤੇ ਉਹ ਇਕ ਮੈਂ ਸੋਚ ਰਹੀ ਸੀਗੀ ਕਿ ਸਕੂਲ ਨਾ ਅਸੀਂ ਹੁਣੇ ਜਲੰਧਰ ਇੱਧਰ ਆਏ ਹਾਂ ਅਤੇ ਸਕੂਲ ਆਪਾਂ ਕਿਹੜਾ ਦੇਖੀਏ ਜਲੰਧਰ ਵਿੱਚ

ਕਿਹੜਾ ਹੈ ਮੈਡਮ ਅੱਛਾ ਅੱਛਾ ਅੱਛਾ ਆ ਜਿਹੜਾ ਹੁਸ਼ਿਆਰਪੁਰ ਰੋਡ 'ਤੇ ਹੈ ਅੱਛਾ ਅੱਛਾ ਅੱਛਾ ਠੀਕ ਹੈ ਮੈਡਮ ਹਾਂ ਉਹਦੇ ਬਾਰੇ ਮੈਂ ਵੀ ਸੁਣਿਆ ਅਤੇ ਕਿਵੇਂ ਦਾ ਸਕੂਲ ਕੁਛ ਕੁਝ ਰਿਵਿਊ ਤੁਹਾਨੂੰ ਪਤਾ ਉਹਦੇ ਬਾਰੇ ਅੱਛਾ ਓਕੇ ਠੀਕ ਹੈ ਠੀਕ ਹੈ ਠੀਕ ਹੈ ਮੈਡਮ ਅੱਛਾ ਅੱਛਾ ਠੀਕ ਹੈ ਠੀਕ ਹੈ ਹਾਂ ਮੈਂ ਤਾਂ ਵੀ ਸੁਣਿਆ ਸੀਗਾ ਕਿ ਉਹ ਆਪਣੇ ਸਿੱਖੀ ਬਾਰੇ ਵੀ ਦੱਸਦੇ ਆ ਹੈ ਨਾ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਵੀ ਕਰਾਉਂਦੇ ਹੈਗੇ ਆ ਹੈ ਨਾ ਉਹਦੇ ਡਿਵੰਟੀ ਦਾ ਵੀ ਉਥੇ ਅੱਛਾ ਠੀਕ ਹੈ ਠੀਕ ਹੈ ਮੈਡਮ ਠੀਕ ਹੈ ਠੀਕ ਹੈ ਮੈਡਮ ਠੀਕ ਹੈ ਅਤੇ ਅੱਛਾ ਤੁਸੀਂ ਗਏ ਆਂ ਪਹਿਲਾਂ ਹੈ ਸਕੂਲ ਹੋ ਗਏ ਸੀ ਤੁਸੀਂ ਹੋਰ ਕੋਈ ਬੱਚਾ ਤੁਹਾਡੇ ਲਾਗੇ ਪੜ੍ਹਦਾ ਅੱਛਾ ਠੀਕ ਹੈ ਮੈਡਮ ਠੀਕ ਹੈ ਹਾਂਜੀ ਚਲੋ ਮੈਡਮ ਜਿਵੇਂ ਹੁਣ ਇਦਾਂ ਆ ਰਿਹਾ ਨਾ ਘਰਾਂ ਵਿੱਚ ਅਤੇ ਅਸੀਂ ਅੱਜ ਕੱਲ੍ਹ ਕਰਦੇ ਹੀ ਨਹੀਂ ਹੈਗੇ ਹੈ ਨਾ ਅਤੇ ਆਪਣੀ ਪੰਜਾਬੀ ਛੁੱਟਦੀ ਜਾਣਡੀ ਹੈ ਨਾ ਅਤੇ ਇਹ ਮੈਨੂੰ ਇਦਾਂ ਦਾ ਕੋਈ ਸਕੂਲ ਚਾਹੀਦਾ ਸੀ ਜਿਹੜਾ ਸਾਡੇ ਬੱਚਿਆਂ ਨੂੰ ਪੰਜਾਬੀ ਦੇ ਨਾਲ ਵੀ ਜੋੜ ਕੇ ਰੱਖੇ ਗੁਰਬਾਣੀ ਨਾਲ ਵੀ ਬੱਚਾ ਜੁੜਿਆ ਰਵੇ ਅਤੇ ਪੰਜਾਬੀਅਤ ਨਾਲ ਵੀ ਜੁੜਿਆ ਰਵੇ ਹੈ ਨਾ ਬੱਚਾ ਸਾਡਾ ਠੀਕ ਹੈ ਮੈਡਮ ਚਲੋ ਕੋਈ ਨਹੀਂ ਫਿਰ ਚਲੀਏ ਕਿਸੇ ਦਿਨ ਆਪਾਂ ਮਾਰ ਕੇ ਆਈਏ ਚੱਕਰ ਹਾਂਜੀ ਇਕ ਦਿਨ ਟਾਈਮ ਹਾਂਜੀ ਠੀਕ ਹੈ ਮੈਡਮ ਚਲੋ ਠੀਕ ਹੈ ਨਾਲੇ ਬੱਚਿਆ ਨੂੰ ਲੈ ਜਾਂਗੇ ਪੁੱਛ ਲਵਾਂਗੇ ਕਿਵੇਂ ਟੈਸਟ ਲੈਂਦੇ ਆ ਜਾਂ ਕੀ ਕਰੇ ਆ ਪਹਿਲਾਂ ਹੈ ਨਾ

ਚਲੋ ਠੀਕ ਹੈ ਮੈਡਮ ਫਿਰ ਟਾਈਮ ਦੱਸ ਠੀਕ ਹੈ ਮੈਡਮ ਕੋਈ ਨਹੀਂ ਮੈਂ ਤੁਹਾਨੂੰ ਨਾ ਸਵੇਰੇ ਇੱਕ ਵਾਰੀ ਫੋਨ ਕਰ ਲਾਂਗੀ ਅਤੇ ਫਿਰ ਆਪਾਂ ਦੇਖ ਕੇ ਅਤੇ ਚਲਦੇ ਹਾਂ ਹੈ ਨਾ ਚਲੋ ਠੀਕ ਹੈ ਮੈਡਮ ਠੀਕ ਹੈ ਚਲੋ ਠੀਕ ਹੈ ਫਿਰ ਮੈਮ ਕੋਈ ਨਹੀ ਕੱਲ੍ਹ ਚਲਦੇ ਫਿਰ ਹੈ ਨਾ ਠੀਕ ਹੈ ਓਕੇ ਸਤਿ ਸ਼੍ਰੀ ਅਕਾਲ ਜੀ